ਮੋਹਾਲੀ ਜਿਲ੍ਹੇ ਵਿੱਚ ਮੁੱਖ ਮਨੋਰੰਜਨ ਗਤੀਵਿਧੀਆਂ ਅਤੇ ਮਨੋਰੰਜਨ ਦੇ ਕਾਫੀ ਵਿਕਲਪ ਹਨ ਖੇਡਾਂ ਬੱਚਿਆਂ ਨੂੰ ਘੁਮਾਉਣ ਲਈ ਵੀ ਆਰ ਪੰਜਾਬ ਜੋ ਕਿ ਖਰੜ ਵਿੱਚ ਹੈ ਐਲਾਂਟੇ ਮਾਲ ਜੋ ਕਿ ਮੋਹਾਲੀ ਵਿੱਚ ਹੈ ਅਤੇ ਬੱਚਿਆਂ ਨੂੰ ਛੁੱਟੀਆਂ ਵਿੱਚ ਘੁੰਮਾਉਣ ਲਈ ਥੰਡਰ ਜ਼ੋਨ ਵਰਗੇ ਕਾਫੀ ਮਨੋਰੰਜਕ ਵਿਕਲਪ ਹਨ ਇਸ ਤੋਂ ਇਲਾਵਾ ਖਾਣ ਪੀਣ ਲਈ ਕਟਾਣੀ ਕੇ ਐਫ ਸੀ ਐੱਲ ਕੇ ਐਫ ਸੀ ਜਾਂ ਹਵੇਲੀ ਵਰਗੀਆਂ ਕਾਫੀ ਖਾਣ ਪੀਣ ਦੀਆਂ ਸ ਜਗ੍ਹਾ ਹਨ ਇਸ ਤੋਂ ਇਲਾਵਾ ਕੁਝ ਵੀ ਖਰੀਦਣ ਲਈ ਜਾਂ ਸ਼ੋਪਿੰਗ ਕਰਨ ਲਈ ਥ੍ਰੀ ਬੀ ਟੂ ਦੀ ਮਾਰਕੀਟ ਬਹੁਤ ਫੇਮਸ ਹੈ ਇਸ ਤੋਂ ਇਲਾਵਾ ਫੇਮਸ ਇਤਿਹਾਸਿਕ ਗੁਰਦੁਆਰੇ ਅੰਬ ਸਾਹਿਬ ਅਤੇ ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਵੀ ਹੈ ਜਿੱਥੇ ਕਿ ਅਸੀਂ ਹਰ ਐਤਵਾਰ ਨੂੰ ਜਾਣ ਦ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਬੱਚਿਆਂ ਲਈ ਬੋਟਨੀਕਲ ਗਾਰਡਨ ਜੋ ਕਿ ਪੀ ਜੀ ਆਈ ਦੇ ਨੇੜੇ ਹੈ ਬਹੁਤ ਵਧੀਆ ਦੇਖਣ ਨੂੰ ਹੈ ਇਸ ਤੋਂ ਇਲਾਵਾ ਦੋ ਸਟੇਡੀਅਮ ਵੀ ਮੋਹਾਲੀ ਜਿਲ੍ਹੇ ਵਿੱਚ ਹਨ ਪੀ ਸੀ ਏ ਕ੍ਰਿਕਟ ਸਟੇਡੀਅਮ ਅਤੇ ਇੱਕ ਮੋਹਾਲੀ ਦਾ ਸਟੇਡੀਅਮ ਜਿਸ ਵਿੱਚ ਕਿ ਕਾਫੀ ਵਾਰ ਇੰਡੀਆ ਦੇ ਕ੍ਰਿਕਟ ਮੈਚ ਅਸੀਂ ਦੇਖਣ ਗਏ ਹਾਂ